ਹੈਲੋ ਸਿਮਰਨਜੀਤ ਮੈਂ ਜਸਵਿੰਦਰ ਸਿੰਘ ਗੱਲ ਕਰ ਰਿਹਾ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਕੀ ਕੱਲ ਮੇਰੇ ਬੇਟੇ ਦਾ ਨਾ ਬਰਥਡੇ ਹੈਗਾ ਵਾ ਜਨਮ ਦਿਨ ਅਸੀਂ ਮਨਾ ਰਹੇ ਆਂ ਸਾਡੇ ਬੇਟੇ ਦਾ ਵੱਡੇ ਬੇਟੇ ਦਾ ਤੇ ਅਸੀਂ ਪੰਜ ਵਜੇ ਪਾਰਟੀ ਦਾ ਪ੍ਰਬੰਧ ਕੀਤਾ ਵਾ ਜਿਸ ਵਿੱਚ ਸਾਰੇ ਮੇਰੇ ਦੋਸਤ ਰਿਸ਼ਤੇਦਾਰ ਆ ਰਹੇ ਨੇ ਮੇਰੇ ਆਫਿਸ ਤੋਂ ਵੀ ਮੇਰੇ ਜਿਹੜੇ ਸਾਥੀ ਕਰਮਚਾਰੀ ਨੇ ਉਹ ਵੀ ਆ ਰਹੇ ਨੇ ਤੇ ਤੁਸੀਂ ਕੱਲ ਪੰਜ ਵਜੇ ਪਾਰਟੀ ਸ਼ੁਰੂ ਹੋਏਗੀ ਤੇ ਤਕਰੀਬਨ ਤਿੰਨ ਘੰਟੇ ਚੱਲੇਗੀ ਤੇ ਅੱਠ ਸਾਢੇ ਅੱਠ ਵਜੇ ਤੁਸੀਂ ਵਿਹਲੇ ਹੋਵੋਗੇ ਤੇ ਤੁਹਾਨੂੰ ਕੱਲ ਐਕਸਟਰਾ ਟਾਈਮ ਲਈ ਰੁਕਣਾ ਪਏਗਾ ਤੁਸੀਂ ਮੈਡਮ ਹਾਂਜੀ ਸਿਰਫ ਇੱਕ ਦਿਨ ਦੀ ਗੱਲ ਆ ਕਿਰਪਾ ਕਰਕੇ ਤੁਸੀਂ ਕਿਸੇ ਤਰ੍ਹਾਂ ਵੀ ਆਪਣਾ ਰਜੈਸਟ ਕਰ ਲਓ ਤੇ ਕਿਉਂਕਿ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਸੀ ਕੱਲ ਬਾਡੇ ਪਾਰਟੀ ਹੈਗੀ ਤੁਸੀਂ ਆਪਣੇ ਘਰ ਦੇ ਕੰਮ ਪਹਿਲਾਂ ਕਰਕੇ ਆ ਜਿਓ ਥੋੜਾ ਲੇਟ ਆ ਜਿਓ ਤੁਸੀਂ ਅੱਠ ਨੋ ਵਜੇ ਆ ਜਿਓ ਤੁਸੀਂ ਤੇ ਉਸ ਤੋਂ ਬਾਅਦ ਤੁਹਾਨੂੰ ਰੁਕਣਾ ਪਏਗਾ ਕਿਉਂਕਿ ਇਹ ਪਾਰਟੀ ਦੇ ਵਿੱਚ ਮੇਰੇ ਰਿਸ਼ਤੇਦਾਰ ਐਕਸਟਰਾ ਪੈਸੇ ਦੇਖੋ ਤੁਸੀਂ ਇਨੇ ਚਿਰ ਤੋਂ ਕੰਮ ਕਰ ਰਹੇ ਆ ਮੈਂ ਤੁਹਾਡਾ ਕਦੀ ਰੱਖਿਆ ਨਹੀਂ ਹੈਗਾ ਤੁਹਾਨੂੰ ਟਾਈਮ ਤੇ ਤੁਹਾਨੂੰ ਪੈਸੇ ਦੇ ਰਿਹਾ ਵਾ ਤੁਹਾਨੂੰ ਇੱਕ ਦਿਨ ਵਾਸਤੇ ਸਿਰਫ ਮੈਂ ਕਹਿ ਰਿਹਾ ਤੁਸੀਂ ਰੁਕ ਜਾਓ ਤੇ ਕੋਈ ਇਡੀ ਵੱਡੀ ਗੱਲ ਲੱਗਦੀ ਨਹੀਂ ਮੈਨੂੰ ਹੈ ਕਿੱਥੇ ਆਪਾਂ ਕੰਮ ਕਰਦੇ ਹੋਈਏ ਰੁਕ ਜਾਣਾ ਚਾਹੀਦਾ ਆਪਾਂ ਨੂੰ ਛੱਡਣ ਜਾਣ ਦਾ ਤੇ ਦੇਖੋ ਸਿਮਰਨ ਤੁਸੀਂ ਇਕ ਦਿਨ ਵਾਸਤੇ ਪ੍ਰਬੰਧ ਕਰ ਲਿਓ ਮੇਰੇ ਰਿਸ਼ਤੇਦਾਰ ਵੀ ਆਏ ਹੋਣੇ ਨੇ ਮੈਂ ਉਹਨਾਂ ਦੇ ਕੋਲ ਬੈਠਣਾ ਹੈ ਤੁਸੀਂ ਕਿਰਪਾ ਕਰਕੇ ਤੁਸੀਂ ਆਪਣੇ ਆਪਣੇ ਹਸਬੈਂਡ ਨੂੰ ਕਿਹੋ ਆਪਣੇ ਜਿਹੜੇ ਪਤੀ ਆ ਉਹ ਥੋਨੂੰ ਲੈ ਜਾਣਗੇ ਤੁਸੀਂ ਉਹਨਾਂ ਨਾਲ ਗੱਲ ਕਰਕੇ ਦੇਖ ਲਿਓ ਇੱਕ ਵਾਰੀ ਉਹ ਘਰੇ ਈ ਆ ਤੇ ਗੱਲ ਕਰਲੋ ਹੁਣੀ ਤੁਸੀਂ ਉਨਾਂ ਨਾਲ ਗੱਲ ਕਰਲੋ ਬਣਾਉਣਾ ਵੇਖੋ ਉਹਦੇ ਵਿੱਚ ਕੇਕ ਜਿਹੜਾ ਉਹ ਤੇ ਆਪਣਾ ਰੇਡੀਮੇਡ ਆ ਜਾਏਗਾ ਹਾਂਜੀ ਹਾਂਜੀ ਰੈਡੀਮੇਡ ਆ ਜਾਏਗਾ ਉਸ ਤੋਂ ਬਾਅਦ ਕੁਝ ਡਿਸ਼ਜ਼ ਨੇ ਆਪਾਂ ਬਣਾਵਾਂਗੇ ਖਾਣ ਪੀਣ ਦੀਆਂ ਜਿੱਦਾਂ ਰੋਟੀ ਦਾ ਪ੍ਰਬੰਧ ਵੀ ਕਰਾਂਗੇ ਰੋਟੀ ਦੇ ਵਿੱਚ ਦਾਲ ਮਟਰ ਪਨੀਰ ਚੋਲ ਵਗੈਰਾ ਦਹੀਂ ਹੋ ਜਾਏਗਾ ਇੱਦਾਂ ਦੀਆਂ ਚੀਜ਼ਾਂ ਆਪਾਂ ਬਣਾਵਾਂਗੇ ਤੁਸੀਂ ਇਦਾਂ ਕਰੋ ਨਾ ਮੋਰਨਿੰਗ ਤੁਸੀਂ ਆ ਜਾਓ ਸੁਵਖਤੇ ਆ ਜਾਓ ਮੈਂ ਤੁਹਾਨੂੰ ਚਲੋ ਇਦਾਂ ਕਰਦਾ ਵਾਂ ਮੈਂ ਤੁਹਾਡੀ ਚਲੋ ਪ੍ਰੋਬਲਮ ਨੂੰ ਸਮਝਦਾ ਵਾਂ ਮੈਂ ਤੁਹਾਨੂੰ ਐਕਸਟਰਾ ਜਿਹੜਾ ਵਾਧੂ ਜਿਹੜਾ ਤੁਸੀਂ ਰੁਕੋਗੇ ਉਹ ਮੈਂ ਤੁਹਾਨੂੰ ਦੇ ਦਊਂਗਾ ਜੋ ਤੁਹਾਡਾ ਬਣੇਗਾ ਤੇ ਤੁਸੀਂ ਰਾਤ ਦੀ ਰੋਟੀ ਤੁਸੀਂ ਇਥੋਂ ਲੈ ਜਿਓ ਜੇ ਤੁਹਾਨੂੰ ਹਨੇਰਾ ਹੁੰਦਾ ਵਾ ਚਲੋ ਮੈਂ ਇਨਾ ਕਰ ਦੂਗਾ ਕਿ ਮੈਂ ਫਿਰ ਤੁਹਾਨੂੰ ਛੱਡ ਵੀ ਆਉਂਗਾ ਜੇਕਰ ਕਿਉਂਕਿ ਸਾਡੇ ਅੱਠ ਨੌ ਵੱਜ ਸਕਦੇ ਨੇ ਆਪਾਂ ਨੂੰ ਪਾਰਟੀ ਖਤਮ ਹੁੰਦੇ ਹੁੰਦੇ ਤੇ ਤੁਸੀਂ ਹੁਣ ਕਿਰਪਾ ਕਰਕੇ ਤੁਸੀਂ ਕੱਲ ਕਿੰਨੇ ਵਜੇ ਪਹੁੰਚੋਗੇ ਫਿਰ ਹਾਂਜੀ ਤੁਸੀਂ ਛੇ ਵਜੇ ਤੁਸੀਂ ਆ ਜੋ ਫਿਰ ਆਪਾਂ ਸਾਰਾ ਪਹਿਲਾਂ ਘਰ ਦਾ ਕੰਮ ਦੋ ਵਜੇ ਤੱਕ ਮੁਕਾ ਕੇ ਫਿਰ ਉਸ ਤੋਂ ਬਾਅਦ ਆਪਾਂ ਤਿਆਰੀਆਂ ਸ਼ੁਰੂ ਕਰ ਦੇਣੀਆਂ ਵਾ ਜੋ ਆਪਾਂ ਸਜਾਵਟ ਕਰਨੀ ਆ ਉਹ ਕਰ ਲਵਾਂਗੇ ਤੇ ਤੁਸੀਂ ਕੱਲ ਛਏ ਵਜੇ ਪਹੁੰਚੋ ਤੇ ਬਾਕੀ ਮੈਂ ਤੁਹਾਨੂੰ ਛੱਡ ਕੇ ਜਾਉਂਗਾ ਇਹ ਜਿੰਮੇਵਾਰੀ ਮੇਰੀ ਐ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ